ਘਰ ਵਿੱਚ ਬਾਗਬਾਨੀ ਲਗਾਉਣ ਦੇ ਚਾਹਵਾਨ ਲੋਕਾਂ ਲਈ ਕਾਫ਼ੀ ਰਚਨਾਤਮਕ ਕੰਮ ਕੀਤੇ ਜਾ ਸਕਦੇ ਨੇ ਜਿਵੇਂ ਮੈੇਨੂੰ ਵੀ ਬਾਗਬਾਨੀ ਕਰਨ ਦਾ ਸ਼ੌਂਕ ਹੈਗਾ ਆਪਣੇ ਘਰ ਵਿੱਚ ਬ ਫ਼ਲਦਾਰ ਅਤੇ ਫੁੱਲਦਾਰ ਬੂਟੇ ਉਗਾਉਣ ਲਈ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨ ਦੀ ਲੋੜ ਹੈਗੀ ਹੈ ਆਪਣੇ ਗਮਲਿਆਂ ਵਿੱਚ ਜਾਂ ਕੋਠੇ ਦੀ ਛੱਤ 'ਤੇ ਅਸੀਂ ਛੋਟੇ ਫ਼ਲਦਾਰ ਜਾਂ ਸਬਜ਼ੀਆਂ ਫੁੱਲਦਾਰ ਬੂਟੇ ਉੱਗਾ ਸਕਦੇ ਹਾਂ ਅਗਰ ਤੁਹਾਡੇ ਵਿਹੜੇ ਵਿੱਚ ਖੁੱਲੀ ਜਗ੍ਹਾ ਹੈਗੀ ਆ ਤਾਂ ਅਸੀਂ ਵੱਡੇ ਬੂਟੇ ਜਿਵੇਂ ਅੰਬਾਂ ਦੇ ਹੋ ਗਏ ਜਾਂ ਅਮਰੂਦ ਹੋ ਗਏ ਜਾਂ ਅਨਾਰ ਹੋ ਗਏ ਇੱਦਾਂ ਦੇ ਫ਼ਲਦਾਰ ਬੂਟੇ ਵੀ ਉੱਗਾ ਸਕਦੇ ਹਾਂ ਅਗਰ ਜਗ੍ਹਾ ਘੱਟ ਹੈਗੀ ਆ ਤਾਂ ਕੋਠੇ ਦੀਆਂ ਛੱਤਾਂ ਜਾਂ ਅੰਦਰ ਰੱਖਣ ਵਾਲੇ ਗਮਲਿਆਂ ਦੇ ਵਿੱਚ ਫੁੱਲਦਾਰ ਅਤੇ ਸਜਾਵਟ ਵਾਲੇ ਬੂਟੇ ਲਗਾ ਸਕਦੇ ਹਾਂ ਫੁੱਲ ਫੁੱਲਦਾਰ ਅਤੇ ਫ਼ਲਦਾਰ ਵੱਡੇ ਬੂਟੇ ਅਸੀਂ ਖੁੱਲ੍ਹੀ ਜਗ੍ਹਾ ਵਿੱਚ ਲਗਾ ਸਕਦੇ ਹਾਂ ਹਰ ਤਰ੍ਹਾਂ ਦੇ ਮੌਸਮ ਅਨੁਸਾਰ ਅਸੀਂ ਆਪਣੇ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਸਬਜ਼ੀਆਂ ਜਾਂ ਫਲ਼ ਅਤੇ ਫੁੱਲਦਾਰ ਬੂਟਿਆਂ ਦੀ ਪੈਦਾਵਾਰ ਕਰ ਸਕਦੇ ਹਾਂ